ਪਿਛਲੇ ਸਾਲ ਹੀ ਸਾਡੇ ਕਲੱਬ ਵੱਲੋਂ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਸਾਡੇ ਕਲੱਬ ਦੇ ਮੈਂਬਰਾਂ ਨੇ ਭਾਗ ਲਿਆ ਮੈਰਾਥਨ ਦੌੜ ਆਮ ਦੌੜ ਦੇ ਨਾਲੋਂ ਕਾਫੀ ਵੱਖਰੀ ਹੁੰਦੀ ਹੈ ਕਿਉਂਕਿ ਇਸ ਵਿੱਚ ਇੱਕ ਨਿਰਧਾਰਿਤ ਦੂਰੀ ਹੁੰਦੀ ਜਿਵੇਂ ਕਿ ਚਾਰ ਕਿਲੋਮੀਟਰ ਅੱਠ ਕਿਲੋਮੀਟਰ ਪੰਦਰ੍ਹਾਂ ਕਿਲੋਮੀਟਰ ਜਾਂ ਫਿਰ ਬਾਈ ਕਿਲੋਮੀਟਰ ਹੁੰਦੀ ਹੈ ਗਰੁੱਪ ਵਿੱਚ ਦੌੜਨ ਦੇ ਨਾਲ ਹੀ ਮੈਰਾਥਨ ਦੌੜ ਦੀ ਦੂਰੀ ਦਾ ਜ਼ਿਆਦਾ ਪਤਾ ਨਹੀਂ ਲੱਗਦਾ ਜਦਕਿ ਜਦੋਂ ਵਿਅਕਤੀ ਇਕੱਲਾ ਦੌੜਦਾ ਹੈ ਤਾਂ ਉਹ ਜਲਦੀ ਹੀ ਥੱਕ ਜਾਂਦਾ ਹੈ ਇਸਦੇ ਉਲਟ ਜਦੋਂ ਵਿਅਕਤੀ ਕਿਸੇ ਸਮੂਹ ਜਾਂ ਆਪਣੇ ਗਰੁੱਪ ਮੈਂਬਰਾਂ ਦੇ ਨਾਲ ਦੌੜਦਾ ਹੈ ਤਾਂ ਉਸਦੀ ਇੱਕ ਨਿਰਧਾਰਿਤ ਚਾਲ ਬਣੀ ਰਹਿੰਦੀ ਹੈ ਜਿਸ ਦੇ ਕਾਰਨ ਉਹ ਦੂਰੀ ਨੂੰ ਹੌਲੀ ਹੌਲੀ ਕਵਰ ਕਰ ਲੈਂਦਾ ਹੈ ਅਤੇ ਦੂਜਿਆਂ ਦੇ ਨਾਲ ਰਲ ਕੇ ਉਸ ਨੂੰ ਸਮੇਂ ਦਾ ਵੀ ਜ਼ਿਆਦਾ ਅਨ ਪਤਾ ਨਹੀਂ ਲੱਗਦਾ ਕਿ ਉਸਨੇ ਕਿੰਨੀ ਦੂਰੀ ਤੈਅ ਕਰ ਲਈ ਹੈ ਫਿਰ ਇਸ ਮੈਰਾਥੋਨ ਦੌੜ ਵਿੱਚ ਦੌੜਨ ਦਾ ਅਨੁਭਵ ਬਹੁਤ ਹੀ ਵਧੀਆ ਰਿਹਾ ਕਿਉਂਕਿ ਅਸੀਂ ਬਾਈ ਕਿਲੋਮੀਟਰ ਢਾਈ ਘੰਟੇ ਦੇ ਵਿੱਚ ਕਵਰ ਕਰ ਲਈ ਸੀ ਜਿਸ ਦੇ ਵਿੱਚ ਸਾਡੇ ਗਰੁੱਪ ਦੇ ਕੁਛ ਮੈਂਬਰ ਪਿੱਛੇ ਵੀ ਰਹਿ ਗਏ ਸੀ ਜੋ ਕਿ ਮੈਰਾਥਨ ਦੌੜ ਨੂੰ ਪੂਰਾ ਨਹੀਂ ਕਰ ਪਾਏ ਪਰ ਅਸੀਂ ਪੰਜ ਛੇ ਜਣੇ ਜੋ ਇਸ ਗਰੁੱਪ ਦੇ ਸ਼ੁਰੂਆਤੀ ਦੌੜ ਵਿੱਚ ਹੀ ਸ਼ਾਮਿਲ ਹੋਏ ਸੀ ਅਸੀਂ ਇਹ ਮੈਰਾਥਨ ਦੌੜ ਨੂੰ ਕਵਰ ਅਪ ਕਰ ਲਿਆ ਸੀ ਅਤੇ ਰਹਿੰਦੇ ਸਮੇਂ ਵਿੱਚ ਵਿੱਚ ਹੀ ਇਸ ਮੈਰਾਥੋਨ ਦੌੜ ਨੂੰ ਖਤਮ ਕਰ ਦਿੱਤਾ ਸੀ ਧੰਨਵਾਦ